ਹਾਂਜੀ ਸਤਿ ਸ਼੍ਰੀ ਅਕਾਲ ਜੀ ਕੌਣ ਬੋਲਦਾ ਭਾਈ ਭਾਈ ਕਿੰਨੇ ਕੁ ਚਿਰ ਦਾ ਕੰਮ ਚਲਦਾ ਆਪਣਾ ਜੀ ਸਾਰਾ ਸਮਾਨ ਤਾਜ਼ਾ ਮਿਲਦਾ ਭਾਈ

ਠੀਕ ਹੈ ਆਪਣੇ ਵਿਆਹ ਦਾ ਪ੍ਰੋਗਰਾਮ ਹੈ ਪੰਜ ਚਾਰ ਦਿਨਾਂ 'ਚ ਪਨੀਰ ਵੀ ਚਾਹੀਦਾ ਤਾਜ਼ਾ ਮੱਖਣ ਚਾਹੀਦਾ ਦੋ ਤਿੰਨ ਕੁਇੰਟਲ ਦੁੱਧ ਚਾਹੀਦਾ ਭਾਈ ਤਾਜ਼ਾ ਇਹ ਦੁੱਧ ਫੈਟ ਦੇ ਨਾਲ ਦੇ ਦਿਓ ਭਾਈ ਹਾਂ ਰੇਟ ਵਗੈਰਾ ਸਾਨੂੰ ਤੁਸੀਂ ਦੱਸ ਦਿਓ ਪੈਮੇਂਟ ਤੁਹਾਡੀ ਗੂਗਲ ਪੇ ਕਰ ਦਿਆਂਗੇ ਤੁਰੰਤ ਪਨੀਰ ਪੰਜ ਛੇ ਕਿਲੋ ਪਨੀਰ ਦੇ ਦਿਓ ਤਾਜ਼ਾ ਦੁੱਧ ਢਾਈ ਕੁ ਕੁਇੰਟਲ ਹਾਂ ਇਹ ਨੋਟ ਕਰ ਨੋਟ ਕਰ ਲਓ ਹਾਂ ਅਤੇ ਸੁਨੇਹਾ ਭੇਜ ਦਿਓ ਭਾਈ ਮੱਖਣ ਵੀ ਚਾਰ ਕੁ ਕਿਲੋ ਦੇ ਦਿਓ ਹਾਂ ਹੋਰ ਕੀ ਹਲਵਾਈ ਨੂੰ ਪੁੱਛ ਕੇ ਫਿਰ ਤੁਹਾਨੂੰ ਕਾਲ ਕਰ ਦਿਆਂਗੇ ਹਲਵਾਈ ਸਾਡੇ ਬਾਜ਼ਾਰ 'ਚੋਂ ਆ ਜੀ ਬਹੁਤ ਮਸ਼ਹੂਰ ਹਲਵਾਈ ਹੈਗਾ

ਹਾਂ ਤੁਹਾਨੂੰ ਭੇਜ ਦਿਆਂਗੇ ਭਾਈ ਅਤੇ ਟਾਈਮ ਨਾਲ ਭੇਜ ਦਿਓ ਠੀਕ ਹੈ ਠੀਕ ਹੈ ਠੀਕ ਹੈ ਇਹ ਤੁਹਾਡੀ ਡੈ ਡੈਰੀ ਤੋਂ ਸਾਡੇ ਜਿਹੜੇ ਗਵਾਂਢੀ ਉਹਨਾਂ ਨੇ ਪਹਿਲਾਂ ਪ੍ਰੋਡਕਟ ਲਏ ਸੀਗੇ ਉਹਨਾਂ ਨੇ ਤੁਹਾਡੀ ਸਿਫਾਰਸ਼ ਕੀਤੀ ਸੀ ਅਤੇ ਹਾਂ ਇਸ ਕਰਕੇ ਤੁਹਾਨੂੰ ਆਰਡਰ ਕੀਤਾ ਆਪ ਦੱਸਿਆ ਹੈਗਾ ਅਤੇ ਅੱਗੇ ਵਾਸਤੇ ਵੀ ਭਾਈ ਥੋਤੋਂ ਮੰਗਵਾਇਆ ਕਰਾਂਗੇ ਥੋੜ੍ਹਾ ਜਿਹਾ ਖਿਆਲ ਰੱਖਿਆ ਕਰੋ ਇਸ ਚੀਜ਼ ਦਾ ਠੀਕ ਹੈ ਠੀਕ ਹੈ

ਠੀਕ ਆ ਠੀਕ ਆ ਹਾਂ ਜੋ ਚੀਜ਼ ਚਾਹੀਦਾ ਉਹ ਤੁਹਾਨੂੰ ਅਸੀਂ ਦੱਸ ਦਿਆਂਗੇ ਠੀਕ ਹੈ ਠੀਕ ਹੈ ਟਾਈਮ ਤੁਹਾਨੂੰ ਬਸ ਆ ਹਲਵਾਈ ਨਾਲ ਕੰਟੈਕਟ ਕਰਕੇ ਨਾ ਟਾਈਮ ਵੀ ਦੱਸ ਦਿਆਂਗੇ ਹਾਂ ਠੀਕ ਹੈ ਠੀਕ ਹੈ ਭਾਈ ਠੀਕ ਹੈ ਠੀਕ ਹੈ ਠੀਕ ਹੈ ਬਹੁਤ ਜੀ ਬਹੁਤ ਚੰਗਾ ਧੰਨਵਾਦ ਸਰ ਠੀਕ ਹੈ ਧੰਨਵਾਦ ਠੀਕ ਆ